ਮੇਰੇ ਸ਼ਹਿਰ ਵਿੱਚ ਬਹੁਤ ਅਜਿਹੀਆਂ ਥਾਵਾਂ ਹਨ ਜਿੱਥੇ ਕਿ ਘੁੰਮਣ ਫਿਰਨ ਲਈ ਬਹੁਤ ਵਧੀਆ ਆ ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਹੈ ਜਿੱਥੇ ਕੁਝ ਵੀ ਖਾਣ ਪੀਣ ਦਾ ਵੀ ਸਮਾਨ ਵਧੀਆ ਕਿਤੇ ਸ਼ੋਪਿੰਗ ਲਈ ਵਧੀਆ ਆ ਪਰ ਮੈਨੂੰ ਵੀ ਆਰ ਮੋਲ ਸਭ ਤੋਂ ਵਧੀਆ ਲੱਗਦਾ ਕਿਉਂਕਿ ਉੱਥੇ ਉੱਥੇ ਜਾ ਕੇ ਮਤਲਬ ਆਪਾਂ ਸ਼ੋਪਿੰਗ ਵੀ ਕਰ ਸਕਦੇ ਹਾਂ ਜਾਂ ਫਿਰ ਮੂਵੀਜ਼ ਵਗੈਰਾ ਵੇਖਣੀ ਹੋਵੇ ਤਾਂ ਉਹ ਵੀ ਵੇਖ ਸਕਦੇ ਹਾਂ ਕੁਛ ਖਾਣ ਪੀਣ ਦਾ ਲੈਣਾ ਹੋਵੇ ਉਹ ਵੀ ਬਹੁਤ ਵਧੀਆ ਉੱਥੇ ਸਭ ਕੁਛ ਅੱਛਾ ਅੱਛਾ ਆ ਮੈਂ ਆਪਣੇ ਫਰੈਂਡਸ ਨਾਲ਼ ਜਾਂ ਫਿਰ ਫੈਮਲੀ ਨਾਲ਼ ਵੀ ਜਾਣਾ ਹੁੰਦਾ ਤਾਂ ਮੈਂ ਉੱਥੇ ਜਾਣਾ ਹੀ ਪ੍ਰੈਫਰ ਕਰਦੀ ਹਾਂ ਹਮੇਸ਼ਾਂ ਉੱਥੇ ਜਾ ਕੇ ਮਤਲਬ ਕਿ ਸਾਰਾ ਉੱਥੇ ਬਿਲਕੁਲ ਅੱਛਾ ਹੈ ਬਹੁਤ ਵਧੀਆ ਹੈ ਸਭ ਕੁਝ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਹੈ ਘੁੰਮਣ ਲਈ ਮੈਂ ਜਿੱਦਾਂ ਕਿ ਸੋਹਾਣਾ ਸਾਹਿਬ ਗੁਰਦੁਆਰਾ ਹੋ ਗਿਆ ਜਦੋਂ ਵੀ ਮੈਂ ਕੁਛ ਵੀ ਮੇਰੇ ਤੋਂ ਕੁਛ ਵੀ ਐਵੇਂ ਦੀ ਆਉਂਦੀ ਹੈ ਕਿ ਮੈਨੂੰ ਕੋਈ ਪ੍ਰੋਬਲਮ ਹੈ ਜਾਂ ਕੁਛ ਵੀ ਹੈ ਮੈਂ ਹਮੇਸ਼ਾਂ ਸੋਹਾਣਾ ਸਾਹਿਬ ਗੁਰਦੁਆਰਾ ਵਿੱਚ ਹੀ ਜਾਂਦੀ ਹਾਂ ਅਤੇ ਮੈਨੂੰ ਉੱਥੇ ਜਾ ਕੇ ਬਹੁਤ ਸ਼ਾਂਤੀ ਮਿਲਦੀ ਮੈਂ ਪਾਠ ਕਰਦੀ ਹਾਂ ਉੱਥੇ ਬੈਠ ਕੇ ਅਤੇ ਹੋਰ ਵੀ ਬਹੁਤ ਕਿ ਮਤਲਬ ਮੈਨੂੰ ਉੱਥੇ ਜਾ ਕੇ ਹੀ ਸਕੂਨ ਮਿਲਦਾ ਆ